ਸਾਨੂੰ ਆਪਣੇ ਭਰਾ ਪੁੱਤਰ ਨੂੰ ਸਿੱਖਿਆ ਚੰਗੀ ਦੇ ਸਕਦੇ ਹਾਂ ਪੁੱਤਰਾਂ ਨੂੰ ਉੱਚ ਸਿੱਖਿਆ ਦੇਣੀ ਚਾਹੀਦੀ ਹੈ ਕੋਈ ਵੀ ਨੌਕਰੀ ਲੈਣ ਵਾਸਤੇ ਸਾਨੂੰ ਸਰਟੀਫਿਕੇਟ ਲੈਣ ਦੀ ਲੋੜ ਹੁੰਦੀ ਹੈ ਪੜ੍ਹਾਈ ਦੇ ਨਾਲ ਨਾਲ ਸਾਨੂੰ ਪੁੱਤਰ ਨੂੰ ਕੋਈ ਹੱਥੀਂ ਕੰਮ ਵੀ ਸਿਖਾਉਣਾ ਚਾਹੀਦਾ ਹੈ ਜਿਸ ਨਾਲ ਬੱਚਾ ਆਪਣੇ ਪੈਰਾਂ ਸਿਰ ਖੜ੍ਹਾ ਹੋ ਜਾਂਦਾ ਹੈ ਅਤੇ ਆਪਣੇ ਰੁਜ਼ਗਾਰ ਦਾ ਵੀ ਪ੍ਰਬੰਧ ਕਰ ਸਕਦਾ ਹੈ ਉੱਚ ਸਿੱਖਿਆ ਵਿੱਚ ਵੀ ਬੱਚੇ ਨੂੰ ਅਜਿਹੇ ਵਿਸ਼ੇ ਚੁਣੇ ਜਾਂਦੇ ਹਨ ਜਿਸ ਦਾ ਉਸਦੀ ਜ਼ਿੰਦਗੀ ਵਿੱਚ ਕੋਈ ਫਾਇਦਾ ਵੀ ਹੋਵੇ ਪੁੱਤਰ ਨੂੰ ਘਰ ਦਾ ਮੁਖੀ ਦੇ ਤੌਰ 'ਤੇ ਵੀ ਮੰਨਿਆ ਜਾਂਦਾ ਹੈ ਇਸ ਲਈ ਪੁੱਤਰ ਨੂੰ ਪੈਰਾਂ ਸਿਰ ਖੜ੍ਹਾ ਕਰਨਾ ਬਹੁਤ ਹੀ ਜ਼ਰੂਰੀ ਹੈ ਪੁੱਤਰ ਨੂੰ ਉੱਚ ਵਿੱਦਿਆ ਦੇਣ ਨਾਲ ਬੱਚੇ ਦੀ ਸੋਚ ਸਮਝ ਵਿੱਚ ਬਹੁਤ ਹੀ ਵਾਧਾ ਹੁੰਦਾ ਹੈ ਪੁੱਤਰ ਪੜ੍ਹਨ ਦੇ ਨਾਲ ਨਾਲ ਘਰ ਪਰਿਵਾਰ ਵਿੱਚ ਵੀ ਕੰਮ ਕਾਰ ਅਤੇ ਕਾਰੋਬਾਰ ਵਿੱਚ ਸਮਝ ਵਿੱਚ ਵਾਧਾ ਹੁੰਦਾ ਹੈ ਇਸ ਲਈ ਪੁੱਤਰ ਪੜ੍ਹਾਉਣਾ ਬਹੁਤ ਹੀ ਜ਼ਰੂਰੀ ਹੈ ਅਤੇ ਉਸਨੂੰ ਚੰਗੀਆਂ ਆਦਤਾਂ ਵੀ ਦੱਸਣੀਆਂ ਬਹੁਤ ਹੀ ਜ਼ਰੂਰੀ ਹਨ